ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੌਣ ਬੋਲਦੇ ਹੋ ਜੀ ਤੁਸੀਂ ਹਾਂਜੀ ਦੱਸੋ ਹਾਂਜੀ ਦੱਸੋ ਮੈਡਮ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਰ ਉਹ ਹਾਂ ਜੀ ਮੈਨੂੰ ਪਤਾ ਕੀ ਹੈ ਜੀ ਉਹ ਘਟਨਾ ਕਿਵੇਂ ਹੋਈ ਜੀ ਉਹ ਪ੍ਰਾਈਵੇਟ ਬੱਸ ਸੀਗੀ ਦੀਪ ਤੇ ਇਧਰੋਂ ਮੁਕਤਸਰ ਤੋਂ ਜਾਂਦੀ ਸੀ ਜੀ ਕੋਟਕਪੂਰਾ ਰੋਡ ਤੇ ਹੀ ਹੋਇਆ ਕੋਟਪੂਰਾ ਜਿਹੜੀਆਂ ਝਵੇਲ ਵਾਲੀਆਂ ਦੋ ਨਹਿਰਾਂ ਚੌੜੀਆਂ ਨਹਿਰਾਂ ਕਹਿੰਦੇ ਨੇ ਉਹਨਾਂ ਨੂੰ ਉਥੇ ਹੋਇਆ ਸੀ ਹਾਂਜੀ ਪਤਾ ਕੀ ਹੈ ਜੀ ਉਹ ਇੱਕ ਤਾਂ ਜੀ ਮੈਂ ਬੱਸ ਪ੍ਰਾਈਵੇਟ ਸੀ ਤੁਹਾਨੂੰ ਪਤਾ ਵੀ ਜਿਵੇਂ ਅੱਜ ਕੱਲ ਜਿਹੜਾ ਹੁਣ ਕਰਾਇਆ ਮਾਫ ਹੋ ਗਿਆ ਜਿਆਦੇ ਹਨਾ ਵੀ ਬੁੜੀਆਂ ਜਿਹੜੀਆਂ ਲੇਡੀਜ ਉਹ ਜਾਂਦੀਆਂ ਨੇ ਸਰਕਾਰੀ ਬੱਸਾਂ ਦੇ ਹਨਾ ਤੇ ਉਹ ਪ੍ਰਾਈਵੇਟ ਬੱਸ ਹੋਣ ਕਰਕੇ ਉਹ ਬਸ ਤੁਹਾਨੂੰ ਪਤਾ ਹੀ ਹੈ ਵੀ ਬੱਸ ਜਿਹੜੇ ਪ੍ਰਾਈਵੇਟ ਬੱਸਾਂ ਵਾਲੇ ਉਹਨਾਂ ਦਾ ਖਰਚਾ ਪੂਰਾ ਕਰਨਾ ਹੁੰਦਾ ਹਨਾ ਵੀ ਤੇਲ ਵਗੈਰਾ ਦਾ ਖਰਚਾ ਕੱਢਣਾ ਹੁੰਦਾ ਹ ਤੇ ਉਹ ਇੱਕ ਤਾਂ ਥੋੜੀ ਜਿਹੀ ਸੀ ਕਾਰਨ ਸੀਗਾ ਵੀ ਬੱਸ ਦੀ ਜਿਹੜੀ ਸਪੀਡ ਸੀ ਉਹ ਬਹੁਤ ਜਿਆਦੇ ਤੇਜ਼ ਸੀਗੀ ਹਨਾ ਦੂਸਰਾ ਉਸ ਦਿਨ ਪਤਾ ਕੀ ਸੀ ਜੀ ਮੀਂਹ ਵੀ ਮੀਂਹ ਪੈ ਰਿਹਾ ਸੀ ਹਨਾ ਮੀਂਹ ਪੈਣ ਦੇ ਨਾਲ ਕੁਛ ਦਾ ਜਿਹੜਾ ਮੰਨ ਕੇ ਚੱਲੀਏ ਵੀ ਸੀਸਾ ਨਹੀਂ ਸੀ ਸਾਫ ਉਹਨਾਂ ਦਾ ਹਨਾ ਬਸ ਦਾ ਤੇ ਜਿਵੇਂ ਜਿਆਦੇ ਬਾਰਸ਼ ਦੇ ਕਰਕੇ ਅੱਗੋਂ ਵੀ ਨਹੀਂ ਸੀ ਦਿਸਦਾ ਤੇ ਇੱਕ ਵੀ ਬਾਰਿਸ਼ ਕਰਕੇ ਜਿਹੜਾ ਚਿੱਕੜ ਹੋ ਗਿਆ ਸੀ ਤੇ ਬਸ ਵੀ ਜਿਹੜਾ ਸਾਡੇ ਹਿਸਾਬ ਨਾਲ ਲੱਗਦਾ ਵੀ ਸਲਿਪ ਹੋ ਗਈ ਇੱਕ ਜਿਹੜੇ ਸਾਡੇ ਰਿਸ਼ਤੇਦਾਰ ਸੀ ਨਾ ਸਾਡੇ ਚਾਚਾ ਦੀ ਲੱਗਦੇ ਆ ਉਹ ਬੱਸ ਦੇ ਵਿੱਚ ਹੀ ਤੇ ਸਪੀਡ ਵੀ ਥੋੜੀ ਜਿਹੀ ਤੇਜ਼ ਸੀਗੀ ਹਨਾ ਵੀ ਜਿਵੇਂ ਸਵਾਰੀਆਂ ਸੀਗੀਆਂ ਜਿਆਦੇ ਉਹ ਸਵਾਰੀਆਂ ਤਕਰੀਬਨ ਪੰਜਾਹ ਕੁ ਤਾਂ ਹੋਣਗੀਆਂ ਜੀ ਪੰਜਾਹ ਤਾਂ ਹੋਣਗੀਆਂ ਹਾਂਜੀ ਹਾਂਜੀ ਵਿੱਚ ਵੀ ਮਤਲਵ ਕੀ ਉਹ ਜਿਹੜੇ ਦੱਸਦੇ ਆ ਸਾਡੇ ਰਿਸ਼ਤੇਦਾਰ ਉਹ ਕਹਿੰਦੇ ਵੀ ਸੀਗੀਆਂ ਤੇ ਬਾਕੀ ਜਿਹੜੇ ਜਿਆਦੇ ਜਿਵੇਂ ਹੁਣ ਸੀਗੇ ਵੀ ਨੇੜੇ ਸੀਗੇ ਬਾਰੀਆਂ ਦੇ ਉਨਾਂ ਨੇ ਤਾਂ ਜਲਦੀ ਸ਼ਾ ਛਾਲਾਂ ਮਾਰਤੀਆਂ ਉਹ ਤਾਂ ਬਚਗੇ ਥੋੜੇ ਬਹੁਤੇ ਤੇ ਬਾਕੀ ਜਦੋਂ ਬੱਸ ਜਮਾਂ ਵਿੱਚ ਈ ਜਾ ਡਿੱਗੀ ਤੇ ਬੱਸ ਦੇ ਵਿੱਚ ਪਾਣੀ ਹੋ ਗਿਆ ਹਨਾ ਤੇ ਮੈਂ ਤਕਰੀਬਨ ਕਾਫੀ ਕਾਫੀ ਨੁਕਸਾਨ ਹੋਇਆ ਉਹਨਾਂ ਬੱਸ ਵਾਲਿਆਂ ਦਾ ਵੀ ਤੇ ਮਤਲਬ ਜਿਹੜਾ ਜਾਨੀ ਮਾਨੀ ਨੁਕਸਾਨ ਆ ਉਹ ਵੀ ਬਹੁਤ ਜਿਆਦੇ ਹੋਇਆ ਹਨਾ ਬੀ ਸਵਾਰੀਆਂ ਜੀ ਕਹਿੰਦੇ ਆ ਵੀ ਦਸ ਪੰਦਰਾਂ ਸਵਾਰੀਆਂ ਤਾਂ ਬਚ ਗਈਆਂ ਹਨਾ ਤੇ ਬਾਕੀ ਹਾਲੇ ਵੀ ਜਿਹੜਾ ਪ੍ਰੋਸੈਸ ਆ ਚੱਲ ਰਿਹਾ ਉਹ ਵੀ ਜਿਵੇਂ ਜਾਂਚ ਚੱਲੀ ਜਾਂਦੀ ਹ ਵੀ ਕਈ ਤਾਂ ਮਿਲ ਗਈਆਂ ਸਵਾਰੀਆਂ ਕਈਆਂ ਦੀਆਂ ਹਲੇ ਲਾਸ਼ਾਂ ਹੀ ਨਹੀਂ ਮਿਲੀਆਂ ਤੇ ਵੀ ਉਹ ਹੌਲੀ ਹੌਲੀ ਜਿਵੇਂ ਹੁਣ ਪੁਲਿਸ ਜਿਹੜੀ ਆਪਣੀ ਜਾਂਚ ਕਰ ਰਹੀ ਆ ਹਨਾ ਤੇ ਬਾਕੀ ਹੋਇਆ ਬਹੁਤ ਮਾੜਾ ਹੀ ਹਨਾ ਬੱਚੇ ਵੀ ਸੀ ਵਿੱਚ ਬਜ਼ੁਰਗ ਵੀ ਸੀ ਹਾਂਜੀ ਹਾਂਜੀ ਹਾਂਜੀ ਹਾਂਜੀ ਦੋਨੋਂ ਨਹਿਰਾਂ ਫੁੱਲ ਸੀਗੀਆ ਫਿਰ ਪਾਣੀ ਉਸ ਦਿਨ ਬਾਰਿਸ਼ ਕਰਕੇ ਨਾ ਜਿਆਦੇ ਵੀ ਸੀਗਾ ਥੋੜਾ ਜਿਹਾ ਤੇ ਉਹ ਜਿਹੜੀ ਰੇਲਿੰਗ ਹਾਂ ਹਾਂਜੀ ਹਾਂਜੀ ਜਿਹੜੀ ਰੇਲਿੰਗ ਸੀਗੀ ਉਹ ਵੀ ਟੁੱਟ ਗਈ ਨਾ ਰੇਲਿੰਗ ਟੁੱਟਣ ਕਰਕੇ ਜਿਆਦੇ ਨੁਕਸਾਨ ਹਾਂ ਜਿਆਦਾ ਨੁਕਸਾਨ ਹਾਂਜੀ ਚਲੋ ਹਾਂਜੀ ਹਾਂ ਵੀ ਜਦੋਂ ਤਾਂ ਸਾਨੂੰ ਹੋਰ ਵੀ ਕੁਝ ਪਤਾ ਲੱਗਦਾ ਤਾਂ ਦੱਸਾਂਗੇ ਜਰੂਰ ਹਾਂਜੀ ਹਾਂਜੀ ਹਾਂਜੀ ਹਾਂਜੀ ਜੇ ਸਾਨੂੰ ਜਾਣਕਾਰੀ ਮਿਲਦੀ ਹ ਤਾਂ ਤੁਹਾਨੂੰ ਜਰੂਰ ਦੱਸਾਂਗੇ ਹਾਂਜੀ ਥੈਂਕਯੂ ਜੀ ਹਾਂਜੀ ਓਕੇ ਜੀ